ਹਾਂਜੀ ਅਸੀਂ ਬਿਜਲੀ ਦੇ ਖ਼ਤਰਿਆਂ ਤੋਂ ਜਾਣੂ ਹਾਂ ਜਿਵੇਂ ਕਿ ਘਰ ਦੇ ਵਿੱਚ ਕੰਮ ਕਰਦੇ ਹੋਏ ਕੋਈ ਵੀ ਬਿਜਲੀ ਦੇ ਸਵਿੱਚ ਨੂੰ ਗਿੱਲੇ ਹੱਥ ਦੇ ਨਾਲ ਬੰਦ ਜਾਂ ਔਨ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਕਿ ਤੁਹਾਨੂੰ ਕਰੰਟ ਲੱਗਣ ਦਾ ਡਰ ਹੁੰਦਾ ਹੈ ਬਾਰਿਸ਼ ਦੇ ਸਮੇਂ ਵਿੱਚ ਆਪਣੇ ਘਰ ਦੇ ਸਾਰੇ ਪਲੱਗ ਨਿਕਾਲ ਦੇਣੇ ਚਾਹੀਦੇ ਹਨ ਕਈ ਵਾਰੀ ਸ਼ੋਰਟ ਸਰਕਟ ਹੋਣ ਨਾਲ ਬਿਜਲੀ ਦੇ ਤੇਜ਼ ਚਮਕਣ ਦੇ ਨਾਲ ਬਿਜਲੀ ਦੇ ਕਰੰਟ ਆਉਣ ਦਾ ਡਰ ਹੁੰਦਾ ਹੈ ਘਰ ਵਿੱਚ ਕੱਪੜੇ ਪ੍ਰੈੱਸ ਕਰਦੇ ਸਮੇਂ ਚੱਪਲ ਹਰ ਵੇਲੇ ਪਾ ਕੇ ਰੱਖਣੀ ਚਾਹੀਦੀ ਹੈ ਨੰਗੇ ਪੈਰ ਨਹੀਂ ਕਰਨੀ ਚਾਹੀਦੀ ਕਰੰਟ ਲੱਗ ਸਕਦਾ ਹੈ ਉਸ ਦਾ ਖ਼ਤਰਾ ਰਹਿੰਦਾ ਹੈ ਪ੍ਰੈੱਸ ਨੂੰ ਸਿੱਧੇ ਤਰੀਕੇ ਇੱਕਦਮ ਖ ਕੱਪੜਿਆਂ 'ਤੇ ਨਹੀਂ ਰੱਖਣਾ ਚਾਹੀਦਾ ਉਸ ਨਾਲ ਅੱਗ ਲੱਗਣ ਦਾ ਅਤੇ ਬਿਜਲੀ ਦਾ ਕਰੰਟ ਲੱਗਣ ਦਾ ਵੀ ਡਰ ਰਹਿੰਦਾ ਹੈ ਬਿਜਲੀ ਤੋਂ ਬਚਣ ਲਈ ਸਾਨੂੰ ਹੋਰ ਵੀ ਕਈ ਉਪਰਾਲੇ ਹਨ ਜੋ ਅਸੀਂ ਕਰ ਸਕਦੇ ਹਾਂ ਘਰ ਤੋਂ ਬਾਹਰ ਜਾਣ ਲਈ ਘਰ ਦਾ ਮੇਨ ਸਵਿੱਚ ਸਾਨੂੰ ਬੰਦ ਕਰਕੇ ਜਾਣਾ ਚਾਹੀਦਾ ਹੈ ਤਾਂ ਜੋ ਕਿ ਬਿਜਲੀ ਦਾ ਲੋਡ ਵੱਧ ਘੱਟ ਆਉਣ ਕਰਕੇ ਸਾਡੇ ਕੋਹੇ ਕਿਸੇ ਸਮਾਨ ਦਾ ਕੋਈ ਨੁਕਸਾਨ ਨਾ ਹੋ ਸਕੇ ਅਤੇ ਬਿਜਲੀ ਦਾ ਵੀ ਸੁਰੱਖਿਅਤ ਰਹੇ